ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਗੂਗਲ ਰਾਹੀਂ ਅਸੀਂ ਵੀਡੀਓ ਕੌਲ 'ਤੇ ਇੱਕ ਦੂਸਰੇ ਨਾਲ ਗੱਲ ਬਾਤ ਵੀ ਕਰ ਸਕਦੇ ਹਾਂ ਮਤਲਬ ਇਸ ਨਾਲ ਸਾਡਾ ਟਾਇਮ ਦੀ ਬੱਚਤ ਹੁੰਦੀ ਹੈ ਅਤੇ ਇੱਕ ਦੂਸਰੇ ਨਾਲ ਸੰਬੰਧ ਵੀ ਜੁੜ ਜਾਂਦੇ ਹਨ ਇਸ ਰਾਹੀਂ ਅਸੀਂ ਇੱਕ ਦੂਸਰੇ ਨੂੰ ਦੂਸਰੇ ਨਾਲ ਗੱਲ ਬਾਤ ਵੀ ਕਰ ਸਕਦੇ ਹਾਂ ਅਤੇ ਸਾਡੇ ਟਾਇਮ ਦੀ ਵੀ ਬੱਚਤ ਹੁੰਦੀ ਹੈ